ਜਿਹੜਾ ਗਾਉਣ ਦਾ ਸ ਮਕੀ ਸ਼ੌਂਕ ਏ ਉਹ ਮੇਰਾ ਇੱਕ ਬਚਪਨ ਦਾ ਮਕੀ ਸ਼ੌਂਕ ਏ ਜਿਹੜਾ ਗਾਉਣਾ ਏ ਗਾਉਣ ਦੇ ਵਿੱਚ ਜਿਹੜੇ ਮੈਂ ਸਾਜਾਂ ਦੇ ਨਾਲ ਮੈਨੂੰ ਪਿਆਰ ਏ ਉਹਦੇ ਵਿੱਚ ਹਰਮੋਨੀਅਮ ਆ ਗਿਆ ਢੋਲ ਆ ਗਿਆ ਤਬਲਾ ਇਹ ਚੀਜ਼ਾਂ ਦੇ ਨਾਲ ਵੀ ਆਪਣਾ ਜਿ ਜਿਹੜਾ ਸੰਗੀਤ ਅੱਛਾ ਵੀ ਬਣਦਾ ਏ ਉਹ ਸੰਗੀਤ ਨਾਲ ਮੈਨੂੰ ਬਹੁਤ ਆਪਣਾ ਪਿਆਰ ਏ ਕਿਉਂਕਿ ਉਹ ਜਿਹੜਾ ਸੰਗੀਤ ਏ ਉਹ ਸੰਗੀਤ ਇੱਕ ਰੂਹ ਦੀ ਖੁਰਾਕ ਏ ਅਤੇ ਉਹ ਆਪਣਾ ਸੰਗੀਤ ਜਦੋਂ ਮੈਂ ਸੁਣਨਾ ਕਿ ਉਹ ਮੇਰੇ ਮਨ ਨੂੰ ਸ਼ਾਂਤੀ ਅੱਛਾ ਵੀ ਆਉਂਦੀ ਏ ਮੇਰੀ ਜਿਹੜੀ ਟੈਨਸ਼ਨ ਏ ਉਹ ਸੰਗੀਤ ਸੁਣਨ ਨਾਲ ਹੀ ਖਤਮ ਹੁੰਦੀ